ਸਾਡੇ ਇਲਾਕੇ ਵਿੱਚ ਦਿਨ ਪ੍ਰਤੀ ਦਿਨ ਅਪਰਾਧ ਵੱਧਦੇ ਜਾ ਰਹੇ ਹਾਂ ਅਤੇ ਸਭ ਤੋਂ ਵੱਡਾ ਅਪਰਾਧ ਹੈ ਕਿ ਜਿਹੜੀਆਂ ਚੋਰੀਆਂ ਡਕੈਤੀਆਂ ਹੋ ਰਹੀਆਂ ਹਨ ਅਤੇ ਲਗਾਤਾਰ ਸੜਕਾਂ ਦੇ ਕਿਨਾਰੇ ਛੀਨਾ ਝਪਟੀ ਹੋ ਰਹੀ ਹੈ ਅਤੇ ਇਹ ਜਿਹੜਾ ਅਪਰਾਧ ਹੈ ਇਹ ਕੁਛ ਗਰੀਬੀ ਦੇ ਕਰਕੇ ਅਤੇ ਕੁਛ ਬੇਰੋਜ਼ਗਾਰ ਦੇ ਕਰਕੇ ਤੀਸਰਾ ਕਾਰਨ ਇਹ ਵੀ ਕਿ ਨਸ਼ੇ ਦੇ ਕਰਕੇ ਵੀ ਹੋ ਰਿਹਾ ਹੈ ਸਾਡੇ ਇਲਾਕੇ ਦੇ ਵਿੱਚ ਰੋਜ਼ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਨ ਅਤੇ ਲੋਕਾਂ ਦੇ ਕਤਲ ਹੋ ਰਹੇ ਹਨ ਥੋੜ੍ਹੇ ਥੋੜ੍ਹੇ ਪੈਸੇ ਲਈ ਲੋਕ ਦੂਸਰੇ ਨੂੰ ਮਾਰਨ ਤੱਕ ਉਤਾਰੂ ਹੋ ਰਹੇ ਹਨ ਅਤੇ ਚੋਰਾਂ ਦਾ ਨਾ ਦਿਨ ਹੁੰਦਾ ਨਾ ਰਾਤ ਹੁੰਦੀ ਹੈ ਚੌਵੀ ਘੰਟੇ ਡਰ ਰਹਿੰਦਾ ਕਿ ਕਿਸ ਟਾਈਮ ਕਿੱਥੇ ਕੋਈ ਅਪਰਾਧ ਹੋ ਜਾਣਾ ਹੈ ਅਤੇ ਅੱਜ ਕੱਲ੍ਹ ਦੇ ਸਮਾਜ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਅਤੇ ਸਾਡੇ ਇਲਾਕੇ ਵਿੱਚ ਜਿਹੜੇ ਅਪਰਾਧ ਵੱਧ ਰਹੇ ਹਨ ਅਤੇ ਇਹਦਾ ਕਾਰਣ ਜਿਹੜੇ ਲੋਕਾਂ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਅਤੇ ਲਗਾਤਾਰ ਭਾਰਤ 'ਚ ਵੱਧ ਰਹੀ ਗਰੀਬੀ ਇਹਨਾਂ ਅਪਰਾਧਾ ਦਾ ਕਾਰਣ ਹੈ